ਹੈਲੋ ਪ੍ਰਗਤੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਐ ਹੋਰ ਮੈਮ ਬਸ ਮੈਮ ਕੁਛ ਨਹੀਂ ਮੈਮ ਬਸ ਵਧੀਆ ਚਲਦਾ ਪਿਆ ਵਧੀਆ ਵ ਹੋਰ ਮੈਮ ਮੈਂ ਤੁਹਾਡੇ ਨਾ ਪੁੱਛਣਾ ਸੀਗਾ ਇੱਕ ਚੀਜ਼ ਬਾਰੇ ਅਤੇ ਜਿਵੇਂ ਅ ਤੁਹਾਡਾ ਬੱਚਾ ਕਿਹੜੇ ਸਕੂਲ 'ਚ ਪੜ੍ਹਦਾ ਅੱਛਾ ਮੈਮ ਅ ਸਕੂਲ ਮੈਂ ਇਹ ਹੀ ਸੋਚ ਰਹੀ ਸੀ ਕਿ ਹੁਣ ਮੇਰੀ ਗਿੱਟੂ ਵੀ ਹੁਣ ਵੱਡੀ ਹੋ ਰਹੀ ਹੈ ਨਾ ਅਤੇ ਮੈਂ ਸਕੂਲਾਂ ਬਾਰੇ ਜਾਣਕਾਰੀ ਲੈਣੀ ਸੀਗੀ ਕਿ ਕਿਹੜਾ ਸਕੂਲ ਵਧੀਆ ਰਹੇਗਾ ਹਾਂਜੀ ਮੈਂ ਉਹ ਹੀ ਪੁੱਛ ਰਹੀ ਸੀ ਕਿਵੇਂ ਮੈਡਮ ਕਿਵੇਂ ਉਹ ਵਧੀਆ ਹੈਗਾ ਸਕੂਲ ਹਾਂਜੀ ਹਾਂਜੀ ਮੈਮ ਮੈਂ ਉਹ ਹੀ ਪੁੱਛ ਰਹੀ ਸੀ ਕਿ ਨਾ ਮੈਂ ਸੁਣਿਆ ਜਿਵੇਂ ਦਸ਼ਮੇਸ਼ ਸਕੂਲ ਬਾਰੇ ਕਿ ਇਹਦੇ 'ਚ ਬੱਚਿਆਂ 'ਤੇ ਨਾ ਪੜ੍ਹਾਈ ਦਾ ਵੀ ਬਹੁਤ ਬੋਝ ਪਾਉਂਦੇ ਆ ਮਤਲਬ ਉਹ ਕਿਵੇਂ ਉਹ ਵੀ ਪੁੱਛਣਾ ਚਾਹ ਰਹੀ ਸੀ ਮੈਂ ਕਿ ਕਿਵੇਂ ਹੈ ਪੜ੍ਹਾਈ ਦੇ ਮਾਮਲੇ 'ਚ ਸਹੀ ਹੈ ਸਕੂਲ ਹਾਂਜੀ ਹਾਂਜੀ ਮੈਮ ਬਿਲਕੁਲ ਸਹੀ ਗੱਲ ਹੈ ਵੈਸੇ ਤਾਂ ਇਹ ਅੱਛਾ ਅੱਛਾ ਮੈਮ ਮੈਮ ਮੈਂ ਇਹ ਹੀ ਕਹਿ ਰਹੀ ਸੀਗੀ ਕਿ ਮਤਲਬ ਜਿਵੇਂ ਇਹ ਇ ਚੀਜ਼ਾਂ ਤਾਂ ਸਾਰੀਆਂ ਸਹੀ ਦੱਸੀਆਂ ਤੁਸੀਂ ਕਿ ਗੇਮਜ਼ ਵਗੈਰਾ ਹੁੰਦੀਆਂ ਪੜ੍ਹਾਈ ਦੇ ਮਾਮਲੇ ਵਿੱਚ ਵੀ ਸਹੀ ਹੈ ਇੰਗਲਿਸ਼ ਵਿੱਚ ਵੀ ਸਹੀ ਹੈ ਮਤਲਬ ਇੰਗਲਿਸ਼ ਕਰਵਾਉਂਦੇ ਇਹਨਾਂ ਨੂੰ ਪਰ ਇਹ ਮਤਲਬ ਬਾਹਲਾ ਵੀ ਬੋਝ ਨਹੀਂ ਆਉਣਾ ਚਾਹੀਦਾ ਨਾ ਬੱਚੇ 'ਤੇ ਕਿ ਉਹ ਬਿਲਕੁਲ ਡਾਊਨ ਹੋ ਜਾਵੇ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਵੀ ਉਹ ਹੀ ਸਕੂਲਾਂ ਬਾਰੇ ਹੀ ਜਾਣਕਾਰੀ ਲੈ ਰਹੀ ਸੀਗੀ ਕਿ ਮਤਲਬ ਇੱਕ ਤਾਂ ਡੀ ਪੀ ਐਸ ਦਾ ਮੈਂ ਨਾਮ ਸੁਣਿਆ ਬਹੁਤ ਇੱਕ ਕੋਂਨਵੈਂਟ ਦਾ ਸੁਣਿਆ ਇੱਕ ਮੇ ਬੀ ਇੱਕ ਇੱਥੇ ਬਾਬਾ ਫਰੀਦ ਵੀ ਹੈਗਾ ਹਾਂਜੀ ਹਾਂਜੀ ਹਾਂਜੀ ਮੈਮ ਪਰ ਮੇਰਾ ਹਜੇ ਕੋਈ ਪਲੈਨ ਨਹੀਂ ਹੈਗਾ ਟੀਚਰ ਦਾ ਟਾਈਮ 'ਤੇ ਮੈਂ ਇਹ ਹੀ ਪੁੱਛ ਰਹੀ ਸੀਗੀ ਕਿ ਇਹਦਾ ਦਾਖਲੇ ਦਾ ਫਿਰ ਕੀ ਇਹਦਾ ਐਡਮੀਸ਼ਨ ਵਗੈਰਾ ਦਾ ਕੀ ਪ੍ਰੋਸੈਸ ਹੁੰਦਾ ਅੱਗੇ

ਹਾਂਜੀ ਹਾਂਜੀ

ਅੱਛਾ ਮੈਮ ਚਲੋ ਵੈਲਕਮ ਹਾਂਜੀ ਹਾਂਜੀ ਮੈਮ ਕਾਨਵੈਂਟ ਹਾਂਜੀ ਹਾਂਜੀ ਮੈਂ ਵੀ ਉਹ ਹੀ ਸੋਚ ਰਹੀ ਸੀ ਨਾ ਕਿ ਹੁਣ ਪਲੇਵੇ 'ਚ ਤਾਂ ਮੈਂ ਕੀ ਲਗਾਵਾਂ ਪਲੇਵੇ ਤਾਂ ਮੇਰਾ ਆਪਣਾ ਹੀ ਹੈ ਮੈਂ ਇਹ ਹੀ ਸੋਚ ਰਹੀ ਸੀ ਜਿਹੜੀ ਬੱਚੇ ਦੀ ਅ ਸਟਾਰਟਿੰਗ ਤੋਂ ਜਿਹੜੀ ਪੜ੍ਹਾਈ ਆ ਹੁਣ ਜਿਹੜੀ ਮੁੱਢਲੀ ਸਿੱਖਿਆ ਉਹ ਸਹੀ ਹੋਣੀ ਚਾਹੀਦੀ ਆ ਤਾਂ ਇੱਕ ਸਹੀ ਸਕੂਲ ਦਾ ਪਤਾ ਲੱਗੇ ਹਾਂਜੀ ਹਾਂਜੀ ਹਾਂਜੀ ਬਿਲਕੁਲ ਚਲੋ ਠੀਕ ਹੈ ਮੈਮ ਥੈਂਕ ਯੂ